ਹੈਲੋ ਹਾਂਜੀ ਮੈਮ ਕੀ ਹਾਲ ਚਾਲ ਆ ਹਾਂਜੀ ਮੈਮ ਠੀਕ ਹੈ ਆਪਣੇ ਸਕੂਲ ਐਨੁਅਲ ਫੰਕਸ਼ਨ ਹੋਇਆ ਕਿੱਦਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਹਾਂਜੀ ਆਪਣੇ ਕਿੰਨੀਆਂ ਐਕਟੀਵਿਟੀ ਸੀਗੀਆਂ ਹਾਂਜੀ ਭੰਗੜਾ ਜੀ ਗਿੱਧਾ ਸੀਗਾ ਗੁਜਰਾਤੀ ਡਾਂਸ ਸੀਗਾ ਹਾਂਜੀ ਹਾਂਜੀ ਗਿੱਧੇ ਦੇ ਵਿੱਚ ਛੋਟੇ ਬੱਚਿਆਂ ਦੀ ਕਿੰਨਾ ਵਧੀਆ ਮੈਸੇਜ ਦਿੱਤਾ ਕਿ ਗਰਲਸ ਨੂੰ ਜਿਹੜਾ ਮਾਰਨਾ ਬੰਦ ਕਰੋ ਉਹਨਾਂ ਨੂੰ ਸਟੱਡੀ ਵੱਲ ਧਿਆਨ ਦਿਓ ਹਾਂਜੀ ਹਾਂਜੀ ਅਤੇ ਜਿਹੜਾ ਭੰਗੜਾ ਸੀ ਉਹਦੇ ਵਿੱਚ ਸਾਰਾ ਦੱਸ ਰਹੇ ਸੀਗੇ ਸਾਰਾ ਹਾਂਜੀ ਹਾਂਜੀ ਉਹਦੇ ਵਿੱਚ ਸਾਰੇ ਇੰਟਰਨੈਟ ਬੱਚਿਆਂ ਨੂੰ ਦੱਸਿਆ ਵੀ ਕਿੱਦਾਂ ਤੁਸੀਂ ਇੰਟਰਨੈਟ ਤੋਂ ਬਚ ਸਕਦੇ ਕਿਦਾਂ ਤੁਸੀਂ ਉਹਨੂੰ ਹੈਲਪਫੁੱਲ ਵੇਅ ਨਾਲ ਯੂਜ ਕਰ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਉਹਨਾਂ ਨੂੰ ਸਟੋਪ ਕਰਨ ਲਈ ਵੀ ਦੱਸਿਆ ਗਿਆ ਕਿੱਦਾਂ ਫਿਰ ਉਹਨਾਂ ਨੂੰ ਇੰਨੀ ਉਹਨਾਂ ਦੀ ਵਸਟ ਕੰਡੀਸ਼ਨ ਹੋ ਜਾਂਦੀ ਉਹਨਾਂ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੇਸਿਕਲੀ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਗਲਤ ਰਸਤੇ ਨਹੀਂ ਜਾਣਾ ਹਮੇਸ਼ਾ ਸਹੀ ਰਸਤੇ ਹੀ ਚਲਣਾ ਇਹ ਸਾਨੂੰ ਗੁਮਰਾਹ ਕਰ ਰਹੇ ਨੇ ਹਾਂਜੀ ਹਾਂਜੀ ਗੁਜਰਾਤੀ ਡਾਂਸ ਸੀਗਾ ਸਾਡੇ ਕਲਚਰ ਨੂੰ ਦੱਸ ਰਿਹਾ ਸੀ ਕਿੰਨਾ ਸਾਡੇ ਹਰ ਇੱਕ ਕਲਚਰ ਦਾ ਰਿਸਪੈਕਟ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਹਾਂਜੀ ਉਹਨਾਂ ਨੂੰ ਇੰਜੋਏਮੈਂਟ ਲਈ ਉਹਨਾਂ ਨੂੰ ਆਪਸ਼ਨ ਮਿਲਿਆ ਉਹਨੇ ਡਰੈਸਿੰਗ ਸੈਂਸ ਦਾ ਕੁਝ ਉਹਨਾਂ ਲਈ ਇੰਜੋਇਮੈਂਟ ਸੀਗਾ ਉਹਨਾਂ ਲਈ ਹਾਂਜੀ ਜਿਵੇਂ ਸਾਡੇ ਬੱਚੇ ਬਾਹਰ ਖੇਲਣ ਗਏ ਉਹਨਾਂ ਨੂੰ ਅਚੀਵਮੈਂਟ ਦਿੱਤੀਆਂ ਉਹਨਾਂ ਨੂੰ ਸਾਰਿਆਂ ਨਾਲੋਂ ਵਧੀਆ ਸੀਗਾ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜੇ ਉੱਥੇ ਆਪਣੇ ਗੈਸਟ ਆਏ ਸੀ ਉਹਨਾਂ ਨੇ ਲੈਕਚਰ ਦਿੱਤਾ ਕਿ ਆਪਾਂ ਕਿੱਦਾਂ ਬੱਚੇ ਨੂੰ ਮੋਟੀਵੇਟ ਕਰ ਸਕਦੇ ਉਹਨਾਂ ਦਾ ਫਿਊਚਰ ਹੋਰ ਕਿੱਦਾਂ ਬਿਲਡਅਪ ਹੋ ਸਕਦਾ ਹਾਂਜੀ ਹੋਰ ਭੰਗੜਾ ਵਧੀਆ ਸੀਗਾ ਭੰਗੜੇ ਵਿੱਚ ਕਲਚਰ ਸਾਰਾ ਦੱਸਿਆ ਗਿਆ ਸੀਗਾ ਕੀ ਕਿੱਦਾਂ ਦੇ ਆਪਣੇ ਕਲਚਰ ਨੂੰ ਅੱਗੇ ਹੋਰ ਮੋਟੀਵੇਟ ਕਰ ਸਕਦੇ ਹੋਰ ਕਿੱਦਾਂ ਆਪਾਂ ਨੂੰ ਵਧਾ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਮੈਮ ਠੀਕ ਆ ਆਪਾਂ ਫਿਰ ਕਰਦੇ ਹਾਂ ਗੱਲ ਠੀਕ ਹੈ ਆਪਾਂ ਛੁੱਟੀਆਂ ਤੋਂ ਬਾਅਦ ਕਰਦੇ ਹਾਂ ਓਕੇ ਜੀ ਮੈਮ ਓਕੇ ਜੀ ਬਾਏ ਬਾਏ